ਹੈਲੋ ਸਤਿ ਸ਼੍ਰੀ ਅਕਾਲ ਅਮਨ ਮੈਂ ਠੀਕ ਆਂ ਤੁਸੀਂ ਦੱਸੋ

ਅੱਛਾ ਤਾਂ ਉਹ ਗਿੱਧਾ ਔਰਗਨਾਈਜ਼ ਕਰਵਾ ਰਹੇ ਨੇ ਠੀਕ ਹੈ ਹਾਂਜੀ ਮੈਂ ਲੈ ਲਵਾਂਗੀ ਭਾਗ ਕਿੰਨੇ ਕੁ ਬੱਚੇ ਨੇ ਕਿੰਨੀ ਕੁੜੀਆਂ ਨੇ ਉਹਦੇ ਵਿੱਚ ਦਸ ਬਾਰਾਂ ਕੁੜੀਆਂ ਨੇ ਅਤੇ ਲੀਡ ਕੌਣ ਕਰ ਰਿਹਾ ਇਹਨੂੰ ਔਰਗਨਾਈਜ਼ ਕੌਣ ਕਰ ਰਿਹਾ ਓਕੇ ਕੋਈ

ਅੱਛਾ ਟ੍ਰੇਨਰ ਸਿਖਾਏਗਾ ਗਿੱਧਾ ਸਾਰਾ ਟਾਈਮਿੰਗਸ ਟਾਈਮਿੰਗਸ ਕੀ ਨੇ ਇਹਦੀਆਂ ਸ਼ਾਮ ਨੂੰ ਪੰਜ ਵਜੇ ਠੀਕ ਹੈ ਓਕੇ ਓਕੇ ਠੀਕ ਹੈ ਤਾਂ ਠੀਕ ਹੈ ਤੁਸੀਂ ਮੈਨੂੰ ਨਾ ਇੱਕ ਵਾਰੀ ਸਾਰੀ ਡਿਟੇਲ ਦੱਸ ਦਿਉ ਘਰ ਆ ਕੇ ਸਮਝਾ ਦਿਉ ਠੀਕ ਹੈ ਹਾਂਜੀ ਮੈਂ ਕਰ ਲਵਾਂਗੀ ਪਾਰਟੀਸੀਪੇਟ ਉਹਦੇ ਵਿੱਚ ਓਕੇ ਬਾਏ